ਦੇਖੋ ਸੰਗੀਤ ਨਾਲ ਮੇਰਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਲਗਾਅ ਰਿਹਾ ਹੈ ਉਹ ਭਾਵੇਂ ਕਿਸੇ ਵੀ ਫੀਲਡ ਵਿੱਚ ਹੋਵੇ ਬਾਕੀ ਰਹੀ ਸੰਗੀਤ ਨੂੰ ਚੋਣ ਕਰਨ ਦੀ ਗੱਲ ਕਿ ਕਿਸ ਤਰ੍ਹਾਂ ਦਾ ਆਪਾਂ ਪੇਸ਼ ਕਰਨਾ ਹੈ ਜਾਂ ਰਿਕਾਰਡ ਕਰਨਾ ਹੈ ਜਾਂ ਦਰਸ਼ਕਾਂ ਜਾਂ ਅੱਗੇ ਲੈ ਕੇ ਆਉਣਾ ਉਹ ਹਰੇਕ ਰਾਈਟਰ ਦੇ ਗੀਤਕਾਰ ਦੇ ਕਲਾਕਾਰ ਦੇ ਆਪਣੇ ਆਪਣੇ ਢੰਗ ਹੁੰਦੇ ਹਨ ਮੇਰਾ ਇਹ ਮੋਟਿਵ ਰਿਹਾ ਹੈ ਕਿ ਸੰਗੀਤ ਰਾਹੀਂ ਆਪਾਂ ਦੂਸਰੇ ਵਿਅਕਤੀ ਨੂੰ ਕੋਈ ਚੰਗੀ ਗੱਲ ਉਸ ਤੱਕ ਪਹੁੰਚਾ ਰਹੇ ਸੱਕੀ ਸਕੀਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਸਿੰਗਰ ਨੇ ਜ਼ਿਆਦਾਤਰ ਸਿੰਗਰ ਨੇ ਅਸਲੇ ਉੱਪਰ ਅ ਅਸਲੇ ਉੱਪਰ ਹੋ ਗਿਆ ਆ ਆਪਣੇ ਦਾਰੂ ਉੱਪਰ ਹੋ ਗਿਆ ਉਹਨਾਂ ਨੂੰ ਵੀ ਦੇਖੋ ਅੱਗੇ ਆਪਣੇ ਸਮਾਜ ਅੱਗੇ ਲਿਆ ਰਹੇ ਨੇ ਉਹ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਆਪਣੇ ਪੱਖ ਨੂੰ ਸੁਰੱਖ ਆਪਣੇ ਇਸ ਪੱਖ ਨੂੰ ਆਪਣੇ ਅੱਗੇ ਪੇਸ਼ ਕਰਦੇ ਰਹੇ ਅਤੇ ਕਰਦੇ ਰਹਿਣਗੇ ਮੈਂ ਉਹਨਾਂ ਸਿੰਗਰਾਂ ਤੋਂ ਜਾਂ ਮੇਰੇ ਵੱਡੇ ਵਡੇਰਿਆਂ ਤੋਂ ਜਾਂ ਮੇਰੇ ਆਲੇ ਦੁਆਲੇ ਦੇ ਵਿੱਚ ਕੀ ਹੋ ਰਿਹਾ ਉਸ ਤੋਂ ਇੰਸਪਾਇਰ ਹੋ ਕੇ ਮੈਂ ਆਪਣਾ ਇਹ ਆਪਣਾ ਟਾਸਕ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਕਿ ਕਿਸੇ ਨੂੰ ਵੀ ਕੋਈ ਹਰਟ ਨਾ ਹੋਵੇ ਅਤੇ ਲੋਕ ਭਲਾਈ ਦੀ ਗੱਲ ਹੋਵੇ ਸਰਬ ਸਾਂਝੇ ਲੋਕਾਂ ਦੀ ਲੋਕਾਂ ਦੀ ਰਾਏ ਹੋਵੇ ਉਹਨਾਂ ਦਾ ਮਾੜਾ ਪੱਖ ਜਾਂ ਸਹੀ ਪੱਖ ਦੋਨਾਂ ਦੀ ਮੈਂ ਚੋਣ ਕਰਦਾ ਹਾਂ